ਜਦੋਂ ਗਰਮੀ ਦਾ ਮੌਸਮ ਆ ਜਾਂਦਾ ਨਾ ਉਦੋਂ ਅਸੀਂ ਤਾਂ ਕਈ ਵਾਰੀ ਸੂਹਿਆਂ 'ਤੇ ਨਹਾਉਣ ਚਲ ਜਾਂਦੇ ਹਾਂ ਘਰ ਦੇ ਵਿੱਚ ਏਸੀ ਲੱਗੇ ਹੁੰਦੇ ਆ ਅਤੇ ਘਰਾਂ ਜਾਂ ਸੱਥ ਦੇ ਵਿੱਚ ਚਲੇ ਜਾਂਦੇ ਹਾਂ ਬੋਹੜਾਂ ਦੀ ਛਾਂ ਹੇਠਾਂ ਆਨੰਦ ਮਾਣਦੇ ਉੱਥੇ ਬੈਠ ਕੇ ਅਤੇ ਕਈ ਵਾਰੀ ਖੁੱਲ੍ਹੇ ਮੈਦਾਨਾਂ ਚੱਲ ਜਾਂਦੇ ਹਾਂ ਉੱਥੇ ਆਨੰਦ ਮਾਣਦੇ ਹਾਂ ਕਈ ਵਾਰੀ ਉੱਥੇ ਸੱਥਾਂ ਦੇ ਤਾਸ਼ ਖੇਡਦੇ ਹੁੰਦੇ ਆ ਉੱਥੇ ਬਹਿ ਜਾਂਦੇ ਉਥੇ ਆਨੰਦ ਮਾਣਦੇ ਹਾਂ ਗਰਮੀਆਂ ਦੇ ਵਿੱਚ ਅਤੇ ਗਰਮੀ ਦੇ ਵਿੱਚ ਛਬੀਲਾਂ ਲਾਈ ਰੱਖਦੇ ਹਾਂ ਠੰਡੇ ਪਾਣੀ ਘਰ ਦੇ ਵਿੱਚ ਨਿੰਬੂ ਪਾਣੀ ਲੈ ਲੈਂਦੇ ਹਾਂ ਅਤੇ ਬੜਾ ਕੁਝ ਅਤੇ ਆਪਸ ਦੇ ਵਿੱਚ ਅਸੀਂ ਗਰਮੀ ਦੇ ਸਰਦੀ ਦੇ ਮੌਸਮ ਵਿੱਚ ਘਰ ਦੇ ਵਿੱਚ ਧੂਣੀ ਬਾਲ ਲੈਂਦੇ ਹਾਂ ਸਰਦੀ ਦੇ ਮੌਸਮ 'ਚ ਘਰ ਦੇ ਵਿੱਚ ਫਿਰ ਇਕੱਠੇ ਹੋ ਜਾਂਦੇ ਹਾਂ ਧੂੰਣੀਆਂ ਬਾਲ ਕੇ ਬੈਠੇ ਰਹਿੰਦੇ ਹਾਂ ਸਰਦੀ ਦੇ ਮੌਸਮ ਵਿੱਚ ਖਾਣ ਪੀਣ ਵਾਸਤੇ ਗਰਮ ਚੀਜ਼ਾਂ ਉਹ ਖਾਂਦੇ ਹਾਂ ਸਰਦੀ ਦੇ ਵਿੱਚ ਸਰਦੀ ਦਾ ਮੌਸਮ ਆਉਂਦਾ ਉਹਦੇ ਇਕੱਠੇ ਬੈਠ ਕੇ ਮੂੰਗਫਲੀ ਖਾਂਦੇ ਇਕੱਠੇ ਬੈਠ ਕੇ ਹੋਰ ਵੀ ਬਹੁਤ ਸਾਰਾ ਸਰਦੀ ਦਾ ਆਨੰਦ ਉਸ ਤਰ੍ਹਾਂ ਮਾਣਦੇ ਅਸੀਂ ਧੰਨਵਾਦ